ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਭਾਈ ਗੁਰਦਾਸ ਲਾਈਬ੍ਰੇਰੀ ਚੋਂ ਹਾਂਜੀ ਹਾਂਜੀ ਹਾਂਜੀ ਹਾਂਜੀ ਸਾਡੀ ਲਾਈਬ੍ਰੇਰੀ ਦੇ ਵਿੱਚ ਪਹਿਲਾਂ ਤਾਂ ਰੀਸੋਰਸ ਜਿਹੜੇ ਸਾਰੇ ਜਿਹਦੇ ਨਾਲ ਵੀ ਰਿਗਾਰਡਿੰਗ ਤੁਹਾਨੂੰ ਚਾਹੀਦੇ ਸਾਰੇ ਅਵੇਲੇਬਲ ਹੈ ਇਹਦੇ ਵਿੱਚ ਅਤੇ ਬਾਕੀ ਕੈਟਾਲੋਗ ਹੋਏ ਨੇ ਕਿਹੜੇ ਸਬਜੈਕਟ ਦੇ ਬਾਰੇ ਤੁਸੀਂ ਜ਼ਿਆਦਾ ਆਪਣੀ ਜਿਹੜੇ ਪੜ੍ਹਨਾ ਚਾਹੁੰਦੇ ਬੁੱਕਸ ਲੈਣੀਆਂ ਚਾਹੁੰਦੇ ਜੇ ਪੰਜਾਬੀ ਬਾਰੇ ਕੈਟਾਲੋਗ ਵੀ ਬਣੇ ਨੇ ਅਤੇ ਕੈਟਾਲੋਗ ਦੇ ਵਿੱਚ ਦੇ ਵਿੱਚ ਔਥਰ ਵਾਈਜ਼ ਸਾਰਾ ਨੰਬਰ ਐਕਸਪ੍ਰੈਸ਼ਨ ਨੰਬਰ ਵਗੈਰਾ ਲੱਗੇ ਤੁਸੀਂ ਉਹ ਦੇਖ ਸਕਦੇ ਜੇ ਹਾਂਜੀ ਔਨਲਾਈਨ ਵੀ ਸਾਡੇ ਕੰਪਿਊਟਰ 'ਤੇ ਤੁਸੀਂ ਸਰਚ ਕਰ ਸਕਦੇ ਜੇ ਰਾਈਟਰ ਦਾ ਨਾਮ ਪਹਿਲਾਂ ਲਿਖ ਕੇ ਉਹਦੇ ਬਾਰੇ ਤੁਹਾਨੂੰ ਜਿਹੜੇ ਬੁੱਕਸ ਨੇ ਉਹ ਅਵੇਲੇਬਲ ਨੇ ਔਨਲਾਈਨ ਵੀ ਸਾਰੀ ਸਰਵਿਸਿਜ਼ ਅਵੇਲੇ ਮੌਜੂਦ ਆ ਉਹਦੇ ਵਿੱਚ ਈਜ਼ੀਲੀ ਤੁਸੀਂ ਆਪਣੀ ਉਹ ਵੀ ਤੁਸੀਂ ਚਲੋ ਓਕੇ ਜੀ ਓਕੇ ਜੀ ਓਕੇ ਸਾਰਾ ਅਵੇਲੇਬਲ ਹੈ ਜੀ ਸਾਡੇ ਕੋਲ ਅਵੇਲੇਬਲ ਆ